ਪੰਜਾਬ ਵਿੱਚ ਹਰੇਕ ਲੋਕ ਆਪਣੇ ਅਨੁਸਾਰ ਮੌਸਮ ਦੇ ਅਨੁਸਾਰ ਆਪਣੀ ਕਾਫੀ ਗਤੀਵਿਧੀਆਂ ਕਰਦਾ ਹੈ ਅਤੇ ਇਹ ਗਤੀਵਿਧੀਆਂ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਮਹੱਤਵ ਰੱਖਦੇ ਹਨ ਜਿਵੇਂ ਕਿ ਜਦੋਂ ਮੈਨੂੰ ਵੀ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਹਨ ਤਾਂ ਮੈਂ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਨਾਲ ਰਲ ਕੇ ਇਹ ਸੋਚਦੀ ਹਾਂ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਰਨਾ ਹੈ ਜਿਵੇਂ ਕਿ ਸਾਡੇ ਘਰ ਦੇ ਵਿੱਚ ਸਭ ਤੋਂ ਜ਼ਿਆਦਾ ਮਨਪਸੰਦ ਚੀਜ਼ ਹੈ ਖਾਣ ਦੀਆਂ ਖਾਣ ਦੇ ਪਕਵਾਨ ਜਿਵੇਂ ਕਿ ਮੇਰੇ ਜੋ ਜਿਹੜੇ ਮੇਰੇ ਪਾਪਾ ਨੇ ਜਦੋਂ ਗਰਮੀਆਂ ਆਉਂਦੀਆਂ ਨੇ ਤਾਂ ਉਹ ਚਾਹੁੰਦੇ ਹਨ ਕਿ ਅਸੀਂ ਅਲੱਗ ਅਲੱਗ ਇੱਦਾਂ ਦੀਆਂ ਚੀਜ਼ਾਂ ਬਣਾਈਏ ਜੋ ਕਿ ਸਾਡੇ ਸਰੀਰ ਲਈ ਠੰਡੀਆਂ ਹੋਣ ਅਤੇ ਸਾਡੇ ਸਰੀਰ ਨੂੰ ਠੰਡਕ ਪਹੁੰਚਾਉਣ ਜਿਵੇਂ ਕਿ ਅਸੀਂ ਗਰਮੀਆਂ ਦੇ ਵਿੱਚ ਪਾਪੜ ਵਗੈਰਾ ਬਣਾਉਂਦੇ ਹਾਂ ਲੱਸੀ ਵਗੈਰਾ ਜਲਜੀਰਾ ਅਤੇ ਹੋਰ ਕੋਈ ਮਿੱਠੀਆਂ ਪਾਣੀ ਦੀਆਂ ਅਸੀਂ ਛਬੀਲ ਵਗੈਰਾ ਕੁਝ ਇੱਦਾਂ ਦੀਆਂ ਚੀਜ਼ਾਂ ਬਣਾਉਂਦੇ ਹਾਂ ਜੋ ਕਿ ਸਾਨੂੰ ਦੁਪਹਿਰ ਦੇ ਸਮੇਂ ਬਹੁਤ ਜ਼ਿਆਦਾ ਠੰਡਕ ਪਹੁੰਚਾਉਂਦੀਆਂ ਹਨ ਅਤੇ ਸਭ ਤੋਂ ਵੱਧ ਅਸੀਂ ਇਹਦੇ ਵਿੱਚ ਇਸਤੇਮਾਲ ਕਰਦੇ ਹਾਂ ਦੁੱਧ ਦਾ ਕਿਉਂਕਿ ਦੁੱਧ ਜਿਹੜਾ ਹੈ ਉਹ ਠੰਡਾ ਹੁੰਦਾ ਹੈ ਅਤੇ ਜੇ ਅਸੀਂ ਉਹਦੇ ਵਿੱਚ ਕੋਈ ਹੋਰ ਚੀਜ਼ ਵੀ ਰੂਹਅਫਜ਼ਾ ਜਲਜੀਰਾ ਵਿੱਚ ਮਿਲਾ ਦਿੰਦੇ ਹਾਂ ਤਾਂ ਇਹ ਹੋਰ ਜ਼ਿਆਦਾ ਵਧੀਆ ਲੱਗਦਾ ਹੈ ਅਤੇ ਸਾਡੇ ਇੱਥੇ ਸਭ ਤੋਂ ਵੱਧ ਸੇਵਨ ਹੁੰਦਾ ਦਹੀਂ ਦਾ ਕਿਉਂਕਿ ਦਹੀਂ ਨੂੰ ਠੰਡਾ ਮੰਨਿਆ ਜਾਂਦਾ ਹੈ ਅਤੇ ਸ ਮੇਰੇ ਸਾਰੇ ਪਰਿਵਾਰ ਦੇ ਮੇਰੀ ਭੈਣਾਂ ਹੋ ਗਈਆਂ ਮੇਰਾ ਭਰਾ ਹੋ ਗਿਆ ਮੇਰੇ ਮੰਮੀ ਡੈਡੀ ਇਹ ਸਾਰੇ ਦਹੀਂ ਨੂੰ ਬਹੁਤ ਚਾਅ ਨਾਲ ਖਾਂਦੇ ਹਨ ਅਤੇ ਅਸੀਂ ਦਹੀਂ ਦੇ ਵਿੱਚ ਕਾਫੀ ਜ਼ਿਆਦਾ ਮਸਾਲੇ ਮਿਲਾ ਦਿੰਦੇ ਹਾਂ ਜਿਵੇਂ ਕਿ ਗਰਮ ਮਸਾਲਾ ਕਾਲੀਆਂ ਮਿਰਚਾਂ ਜੀਰੇ ਦਾ ਪਾਊਡਰ ਨਮਕ ਮਿਰਚ ਆਦਿ ਨੂੰ ਵਿੱਚ ਮਿਲਾ ਕੇ ਦਹੀਂ ਦਾ ਆਨੰਦ ਮਾਣਦੇ ਹਾਂ ਅਤੇ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਅਸੀਂ ਸਾਰਾ ਪਰਿਵਾਰ ਰਲ ਮਿਲ ਕੇ ਖੇਡਦੇ ਹਨ ਜਿਵੇਂ ਕਿ ਕੈਰਮ ਬੋਰਡ ਚਿੜੀ ਛੱਕਾ ਗੀਟੇ ਪੀਚੋ ਮੈਂ ਆਪਣੇ ਡੈਡੀ ਨਾਲ ਸਭ ਤੋਂ ਵੱਧ ਚਿੜੀ ਛੱਕਾ ਖੇਡਦੀ ਹਾਂ ਅਤੇ ਇਹਦੇ ਵਿੱਚ ਸਾਡਾ ਸਾਰਾ ਪਰਿਵਾਰ ਰਲ ਕੇ ਖੇਡਦਾ ਹੈ ਜਦੋਂ ਮਲ ਅਸੀਂ ਅਲੱਗ ਅਲੱਗ ਖੇਡਦੇ ਹਾਂ ਜਿਵੇਂ ਕਿ ਕਦੇ ਮੈਂ ਆਪਣੀ ਭੈਣ ਨਾਲ ਖੇਡਣ ਲੱਗ ਜਾਂਦੀ ਹਾਂ ਜਦੋਂ ਉਹ ਆਊਟ ਹੋ ਜਾਂਦੀ ਆ ਤਾਂ ਮੈਂ ਆਪਣੇ ਭਰਾ ਨਾਲ ਜਦੋਂ ਉਹ ਆਊਟ ਹੋ ਜਾਂਦਾ ਤਾਂ ਮੈਂ ਆਪਣੇ ਡੈਡੀ ਨਾਲ ਅਤੇ ਜਦੋਂ ਉਹ ਆਊਟ ਹੋ ਜਾਂਦੇ ਨੇ ਤਾਂ ਮੈਂ ਆਪਣੀ ਮੰਮੀ ਨਾਲ ਇਵੇਂ ਇਹ ਸਾਡੀ ਵਾ ਵਾਰੀ ਵਾਰੀ ਸਿਰ ਜਿਵੇਂ ਕੋਈ ਆਊਟ ਹੁੰਦਾ ਉਹਦੀ ਜਗ੍ਹਾ ਕੋਈ ਹੋਰ ਆ ਜਾਂਦਾ ਹੈ ਅਤੇ ਇਵੇਂ ਅਸੀਂ ਆਪਣੀ ਗਰਮੀਆਂ ਦੇ ਦਿਨ ਆਪਸ ਦੇ ਵਿੱਚ ਰਲ ਮਿਲ ਕੇ ਗੁਜ਼ਾਰਦੇ ਹਾਂ ਅਤੇ ਸਰਦੀਆਂ ਦੇ ਵਿੱਚ ਅਸੀਂ ਕੀ ਕਰਦੇ ਹਾਂ ਅਸੀਂ ਸਵੇਰ ਦਾ ਕੰਮ ਮੰਮ ਅਸੀਂ ਮੇਰੀ ਭੈਣਾਂ ਅਤੇ ਮੰਮ ਮੰਮੀ ਅਸੀਂ ਸਵੇਰ ਦਾ ਕੰਮ ਸਾਰਾ ਖਤਮ ਕਰਕੇ ਅਸੀਂ ਕੋਠੇ 'ਤੇ ਬਹਿ ਜਾਂਦੇ ਹਾਂ ਅਤੇ ਜਿਹੜੇ ਮੇਰੇ ਮੰਮੀ ਨੇ ਉਹ ਫੁਲਕਾਰੀਆਂ ਕੱਢਦੇ ਹਨ ਚੁੰਨੀਆਂ ਦੇ ਉੱਤੇ ਅਲੱਗ ਅਲੱਗ ਤਰ੍ਹਾਂ ਦੇ ਡਿਜ਼ਾਇਨ ਬਣਾਉਂਦੇ ਹਨ ਸੋ ਇਹਦੀ ਇਸਤੇਮਾਲ ਕਰਕੇ ਅਤੇ ਅਸੀਂ ਉੱਥੇ ਬੈਠ ਕੇ ਆਪਣਾ ਗਰ ਸ ਘਰ ਸਕੂਲ ਦਾ ਕੰਮ ਜਾਂ ਕਾਲਜ ਦਾ ਕੰਮ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਖੇਤਾਂ ਦੇ ਵਿੱਚ ਵੀ ਜਾਂਦੇ ਹਾਂ ਉਥੇ ਅਲੱਗ ਅਲੱਗ ਚੀਜ਼ਾਂ ਤੋੜ ਕੇ ਲਿਆਉਂਦੇ ਹਾਂ ਅਤੇ ਉਨ ਜ਼ਿਆਦਾਤਰ ਅਸੀਂ ਖੇਤਾਂ ਦੇ ਵਿੱਚ ਸਾਗ ਤੋੜ ਕੇ ਲਿਆਉਂਦੇ ਹਾਂ ਅਤੇ ਕੋਠੇ ਸਾਡੇ ਕੋਠੇ ਦੇ ਉੱਤੇ ਚੁੱਲ੍ਹਾ ਬਣਿਆ ਹੋਇਆ ਅਤੇ ਅਸੀਂ ਉਸ ਚੁੱਲ੍ਹੇ ਦੇ ਵਿੱਚ ਪਾਥੀਆਂ ਲੱਕੜੀਆਂ ਨੂੰ ਬਾਲ ਕੇ ਉਹਦੇ ਉੱਤੇ ਅਸੀਂ ਸਾਗ ਧਰਦੇ ਹਾਂ ਅਤੇ ਮੇਰੀ ਮੰਮੀ ਸਾਗ ਨੂੰ ਬਣਾਉਂਦੇ ਹਨ ਅਤੇ ਅਸੀਂ ਨਾਲ ਬੈਠ ਕੇ ਉਸ ਸਿੱਖਦੇ ਹਾਂ ਕਿ ਸਾਗ ਕਿਵੇਂ ਬਣਾਈ ਦਾ ਆ ਅਤੇ ਅਸੀਂ ਮੰਮੀ ਦੀ ਹੈਲਪ ਕਰਦੇ ਹਾਂ ਅਤੇ ਜਦੋਂ ਮੇਰੇ ਪਾਪਾ ਘਰ ਆ ਜਾਂਦੇ ਹਨ ਤਾਂ ਅਸੀਂ ਉਹ ਨਾਲ ਸੰਤਰੇ ਲਿਆਉਂਦੇ ਹਨ ਤਾਂ ਅਸੀਂ ਕੋਠੇ 'ਤੇ ਬੈਠ ਕੇ ਸੰਗਤਰਿਆਂ ਨੂੰ ਚੀਰ ਕੇ ਖਾਂਦੇ ਹਾਂ ਅਤੇ ਹੋਰ ਕਾਫੀ ਫਰੂ ਫਲਾਂ ਵਗੈਰਾ ਦਾ ਸੇਵਨ ਕਰਦੇ ਹਾਂ ਅਤੇ ਅਸੀਂ ਚੁੱਲ੍ਹੇ ਦੇ ਕੋਲ ਬੈਠ ਕੇ ਅੱਗ ਵੀ ਸੇਕਦੇ ਹਾਂ ਆਪਣੇ ਸਰੀਰ ਨੂੰ ਗਰਮਾਹਟ ਦੇਣ ਲਈ ਅਸੀਂ ਕਾਫੀ ਖੇਡਾਂ ਦਾ ਵੀ ਖੇਡਾਂ ਵੀ ਖੇਡਦੇ ਹਾਂ ਅਤੇ ਫਲ ਵਗੈਰਾ ਸਾਰਾ ਕੁਛ ਖਾਂਦੇ ਹਾਂ ਅਤੇ ਅਸੀਂ ਜ਼ਿਆਦਾਤਰ ਠ ਠੰਡਾਂ ਦੇ ਵਿੱਚ ਚਾਹ ਦਾ ਸੇਵਨ ਕਰਦੇ ਹਾਂ ਜਿਵੇਂ ਕਿ ਸਵੇਰੇ ਟਾਈਮ ਚਾਹ ਹੋ ਗਈ ਦੁਪਹਿਰ ਨੂੰ ਚਾਹ ਹੋ ਗਈ ਸ਼ਾਮ ਨੂੰ ਚਾਹ ਹੋ ਗਈ ਰਾਤ ਨੂੰ ਚਾਹ ਹੋ ਗਈ ਅਤੇ ਅਸੀਂ ਦਿਨ ਦੇ ਵਿੱਚ ਚਾਰ ਵਾਰ ਪੂਰੇ ਇੱਕ ਦਿਨ ਦੇ ਵਿੱਚ ਚਾਰ ਵਾਰ ਚਾਹ ਦਾ ਸੇਵਨ ਕਰਦੇ ਹਾਂ ਅਤੇ ਅਸੀਂ ਸਰਦੀਆਂ ਦੇ ਵਿੱਚ ਵੀ ਆਪਣੇ ਰਿਸ਼ਤੇਦਾਰਾਂ ਦੇ ਘਰ ਚਲੇ ਜਾਂਦੇ ਹਾਂ ਜਿਵੇਂ ਕਿ ਗੱਚਕ ਵਗੈਰਾ ਦੇਣ ਮੂੰਗਫਲੀਆਂ ਵਗੈਰਾ ਦੇਣ ਅਤੇ ਅਸੀਂ ਘਰ ਵੀ ਬਹੁਤ ਜ਼ਿਆਦਾ ਮੂੰਗਫਲੀਆਂ ਵਗੈਰਾ ਗੱਚਕ ਵਗੈਰਾ ਪਿੰਨੀਆਂ ਵਗੈਰਾ ਸਾਡੇ ਇੱਥੇ ਵੱਡ ਵਡੇਰਿਆਂ ਤੋਂ ਮੱਠਾ ਮੱਥਾ ਟੇਕਿਆ ਜਾਂਦਾ ਹੈ ਜਿਹਦੇ ਵਿੱਚ ਅਸੀਂ ਪੂਰੇ ਸਾਲ ਤੋਂ ਦੇਸੀ ਘੀ ਨੂੰ ਜਮ੍ਹਾਂ ਕਰਦੇ ਹਾਂ ਅਤੇ ਉਸ ਸਰਦੀਆਂ ਦੇ ਵਿੱਚ ਜਦੋਂ ਦਸੰਬਰ ਦੇ ਮਹੀਨੇ ਵਿੱਚ ਅਸੀਂ ਉਸ ਦੇਸੀ ਘੀ ਨੂੰ ਸਾਰੇ ਨੂੰ ਇਕੱਠਾ ਕਰਕੇ ਉਹਦਾ ਇਸਤੇਮਾਲ ਕਰਕੇ ਪੰਜੀਰੀ ਬਣਾਉਂਦੇ ਹਾਂ ਅਤੇ ਪੰਜੀਰੀ ਦੇ ਵਿੱਚ ਕਾਫੀ ਸਾਰਾ ਸਮਾਨ ਪੈਂਦਾ ਜਿਵੇਂ ਕਿ ਗਰਮ ਚੀਜ਼ਾਂ ਜਿਵੇਂ ਕਿ ਗੁ ਗੁੰਡੋ ਹੋ ਗਈ ਆਪਣਾ ਮਿੱਠਾ ਸੂਜੀ ਹੋ ਗਈ ਦੇਸੀ ਖੰਡ ਹੋ ਗਈ ਕਾਜੂ ਬਦਾਮ ਦਾਖਾਂ ਮਖਾਣੇ ਆਦਿ ਕਾਫੀ ਚੀਜ਼ਾਂ ਦਾ ਕਾਫੀ ਚੀਜ਼ਾਂ ਪੰਜੀਰੀ ਦੇ ਵਿੱਚ ਪਾਉਂਦੇ ਹਾਂ ਜੋ ਕਿ ਗਰਮ ਹੁੰਦੀਆਂ ਹਨ ਅਤੇ ਅਸੀਂ ਇਹ ਬਣਾ ਕੇ ਪੰਜੀਰੀ ਵੱਡੀ ਕੜਾਹੀ ਦੇ ਵਿੱਚ ਬਣਾਉਂਦੇ ਹਾਂ ਤਾਂ ਪੰ ਪੰਜੀਰੀ ਬਣਾਉਣ ਨੂੰ ਕਾਫੀ ਟਾਈਮ ਲੱਗਦਾ ਅਸੀਂ ਦੋ ਦੋ ਵਾਰੀਆਂ ਦੇ ਵਿੱਚ ਪੰਜੀਰੀ ਨੂੰ ਬਣਾਉਂਦੇ ਹਾਂ ਕਿਉਂਕਿ ਸਾਡਾ ਦੇਸੀ ਘੀ ਕਾਫੀ ਇਕੱਠਾ ਹੋ ਜਾਂਦਾ ਹੈ ਅਤੇ ਉਹਦੇ 'ਚ ਦੇਸੀ ਖੰਡ ਵੀ ਕਾਫੀ ਜ਼ਿਆਦਾ ਇਸਤੇਮਾਲ ਹੁੰਦੀ ਹੈ ਇਸ ਕਰਕੇ ਦੋ ਵਾਰੀ ਦੇ ਵਿੱਚ ਅਸੀਂ ਉਹਨੂੰ ਕੋਠੇ 'ਤੇ ਚੁੱਲ੍ਹੇ ਦੇ ਉੱਤੇ ਬਣਾਉਂਦੇ ਹਾਂ ਅਤੇ ਜਦੋਂ ਉਹ ਬਣ ਜਾਂਦੀ ਹੈ ਤਾਂ ਅਸੀਂ ਉਸ ਨਾਲ ਵੱਡ ਵਡੇਰਿਆਂ ਦਾ ਮੱਥਾ ਟੇਕਦੇ ਹਾਂ ਅਤੇ ਇਹ ਵੱਡ ਵਡੇਰਿਆਂ ਦਾ ਮੱਥਾ ਸਿਰਫ ਸਾਡੇ ਘਰ ਦੇ ਮੁੰਡੇ ਨੂੰਹਾਂ ਜਾਂ ਮੇਰੇ ਪਾਪਾ ਜਾਂ ਮੁੰਡੇ ਟੇਕ ਸਕਦੇ ਹਨ ਕੁੜੀਆਂ ਇਸ ਮੱਥੇ ਨੂੰ ਨਹੀਂ ਟੇਕ ਸਕਦੀਆਂ ਅਤੇ ਅਸੀਂ ਇਹ ਪੰਜੀਰੀ ਜਦੋਂ ਵੀ ਜੇ ਕਿਸੇ ਹੋਰ ਰਿਸ਼ਤੇਦਾਰ ਨੂੰ ਜਾਂ ਆਪਣੇ ਘਰ ਦੇ ਕਿਸੇ ਵੀ ਜੀਅ ਨੂੰ ਕਿਤੇ ਇੱਕ ਇੱਕ ਘਰ ਤੋਂ ਕਿਸੇ ਹੋਰ ਜਗ੍ਹਾ ਜਾਣਾ ਹੁੰਦਾ ਤਾਂ ਅਸੀਂ ਪੰਜੀਰੀ ਨੂੰ ਜਦੋਂ ਡੱਬੇ ਵਿੱਚ ਰੱਖਦੇ ਹਾਂ ਤਾਂ ਉਸ ਪੰਜੀਰੀ ਦੇ ਨਾਲ ਅਸੀਂ ਲਸਣ ਦਾ ਇੱਕ ਟੁਕੜਾ ਜਾਂ ਇੱਕ ਮੇਖ ਦੀ ਕਿੱਲ ਵੀ ਰੱਖਦੇ ਹਾਂ ਕਿਉਂਕਿ ਮੰਨਿਆ ਜਾਂਦਾ ਕਿ ਜਿਹੜੀ ਚੀਜ਼ ਸ਼ੁੱਧ ਹੁੰਦੀ ਹੈ ਜਾਂ ਦੇਸੀ ਘੀ ਦੀ ਬਣੀ ਹੁੰਦੀ ਹੈ ਕਿ ਉਸ ਚੀਜ਼ ਨੂੰ ਜੇ ਅਸੀਂ ਘਰ ਤੋਂ ਕਿਤੇ ਦੂਰ ਲਿਜਾ ਕੇ ਜਾ ਰਹੇ ਹਾਂ ਤਾਂ ਉਹਦੇ ਵਿੱਚ ਇਹ ਚੀਜ਼ਾਂ ਹੋਣੀਆਂ ਜ਼ਰੂਰੀ ਹਨ ਜਿਵੇਂ ਕਿ ਲੋਹੇ ਦੀ ਕਿੱਲ ਅਤੇ ਲਸਣ ਕਿਉਂਕਿ ਮੰਨਿਆ ਜਾਂਦਾ ਹੈ ਕਿ ਸ਼ੁੱਧ ਚੀਜ਼ ਦੇ ਪਿੱਛੇ ਪ੍ਰੇਤ ਆਤਮਾ ਵਗੈਰਾ ਆਉਂਦੀਆਂ ਹਨ ਅਤੇ ਕੋਈ ਚੀਜ਼ ਜੇ ਕਿਸੇ ਜਗ੍ਹਾ 'ਤੇ ਵਾਸ ਕਰਦੀ ਹੁੰਦੀ ਹੈ ਤਾਂ ਉਹਦੇ ਪਿੱਛੇ ਆ ਜਾਂਦੀ ਹੈ ਅਤੇ ਅਸੀਂ ਇਹਨਾਂ ਚੀਜ਼ਾਂ ਦਾ ਹੀ ਸੇਵਨ ਕਰ ਗਰਮੀਆਂ ਦੇ ਵਿੱਚ ਅਲੱਗ ਚੀਜ਼ਾਂ ਦਾ ਸੇਵਨ ਕਰਦੇ ਹਾਂ ਜੋ ਕਿ ਠੰਡੀਆਂ ਹੁੰਦੀਆਂ ਹਨ ਅਤੇ ਸਰਦੀਆਂ ਦੇ ਵਿੱਚ ਉਹ ਚੀਜ਼ਾਂ ਦਾ ਸੇਵਨ ਕਰਦੇ ਹਾਂ ਜੋ ਕਿ ਸਾਡੇ ਸਰੀਰ ਲਈ ਗਰਮ ਹੋਣ ਅਤੇ ਅਸੀਂ ਇਵੇਂ ਆਪਣੀ ਸਰਦੀਆਂ ਅਤੇ ਗਰਮੀਆਂ ਦਾ ਮੌਸਮ ਹੱਸਦੇ ਖੇਡਦੇ ਹੋਏ ਖਾਂਦੇ ਪੀਂਦੇ ਹੋਏ ਗੁਜ਼ਾਰਦੇ ਹਾਂ